ਮੈਂ ਬਠਿੰਡਾ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਵੀ ਮੈਂ ਰੈਸਟੋਰੈਂਟ ਤੋਂ ਗੋਪਾਲ ਰੈਸਟੋਰੈਂਟ ਗੋਪਾਲ ਸਵੀਟ ਰੈਸਟੋਰੈਂਟ ਤੋਂ ਆਪਦਾ ਖਾਣ ਪੀਣ ਦਾ ਸਮਾਨ ਮੰਗਵਾਉਂਦੀ ਹਾਂ ਵੀ ਮੇਰਾ ਨਾਮ ਰਮਨਦੀਪ ਕੌਰ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਅਤੇ ਉਹ ਵੀ ਮੈਂ ਉਹਨਾਂ ਉਹ ਮੇਰੇ ਫੋਨ ਨੰਬਰ ਤੋਂ ਵੀ ਮੇਰੇ ਫੋਨ ਕਰਨ ਦੇ ਬਾਵਜੂਦ ਨਾਲ ਦੀ ਨਾਲ ਹੀ ਮੈਨੂੰ ਖਾਣਾ ਪਹੁੰਚਾ ਦਿੰਦੇ ਆ ਜੋ ਵੀ ਮੈਂ ਉਹਨਾਂ ਤੋਂ ਕੁਛ ਆਪਦਾ ਖਾਣ ਪੀਣ ਦਾ ਮੰਗਵਾਉਂਦੀ ਹਾਂ ਵੀ ਉਹ ਮੇਰੇ ਤੋਂ ਜਾਣੂ ਆ ਚੰਗੀ ਤਰ੍ਹਾਂ ਹੁਣ ਮੈਂ ਆਪਦਾ ਐਡਰੈਸ ਚੇਂਜ ਕਰ ਲਿਆ ਜਿਹਦੇ ਵਿੱਚ ਵੀ ਮੈਂ ਹੁਣ ਪਹਿਲਾਂ ਅਜੀਤ ਨਗਰ ਰਹਿੰਦੀ ਸੀ ਹੁਣ ਮੈਂ ਰਾਮ ਜੀ ਨਗਰ ਰਹਿਣ ਲੱਗ ਗਈ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਮੇਰਾ ਐਡਰੈਸ ਵੀ ਲਿਖ ਲੈਣ ਮੇਰਾ ਨਾਮ ਰਮਨਦੀਪ ਕੌਰ ਆ ਰਾਮ ਜੀ ਨਗਰ 'ਚ ਮੇਰਾ ਨੰਬਰ ਗਲੀ ਨੰਬਰ ਮੇਰੀ ਪੰਜ ਆ ਤਿੰਨ ਸੌ ਚਾਰ ਮੇਰਾ ਹਾਊਸ ਨੰਬਰ ਆ ਅਤੇ ਹੁਣ ਮੈਨੂੰ ਮੇਰਾ ਸਾਰਾ ਖਾਣ ਪੀਣ ਦਾ ਸਮਾਨ ਇੱਥੇ ਪਹੁੰਚਾ ਦਿਆ ਕਰਨ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਹੋਊਂਗੀ